ਸਾਡੇ ਸਥਾਨ ਦੇ ਮੂਲ ਕਲਾ ਜੇਕਰ ਮੰਨਿਆ ਜਾਵੇ ਸਾਡੇ ਪੰਜਾਬ ਦੇ ਏਰੀਏ ਦੇ ਵਿੱਚ ਜ਼ਿਆਦਾ ਸ਼ਿਲਪਕਾਰੀ ਹਨ ਜੋ ਕਿ ਮਿੱਟੀ ਦੇ ਭਾਂਡੇ ਬਣਾਉਂਦੇ ਨੇ ਅਤੇ ਉਹ ਮਿੱਟੀ ਦੇ ਭਾਂਡੇ ਬਹੁਤ ਹੀ ਖੂਬਸੂਰਤੀ ਤਰੀਕੇ ਨਾਲ ਬਣਾਉਂਦੇ ਨੇ ਉਹਨਾਂ ਦੇ ਵਿੱਚ ਜਿਵੇਂ ਗਲਾਸ ਥਾਲ ਅਤੇ ਪੀਣ ਵਾਲੇ ਕੈਂਪਰ ਸਬੰਧੀ ਬਹੁਤ ਜ਼ਿਆਦਾ ਸੋਹਣੇ ਕਲਾਕ੍ਰਿਤੀ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਥਾਵਾਂ 'ਤੇ ਉਹਨਾਂ ਨੂੰ ਵੇਚਿਆ ਵੀ ਜਾਂਦਾ ਅਤੇ ਉਹ ਆਪ ਆਪਣਾ ਇੱਕ ਗੁਜ਼ਾਰਾ ਕਰ ਰਹੇ ਹਨ ਧੰਨਵਾਦ